ਹਾਂਜੀ ਸਕੂਲ ਵਿੱਚ ਲਾਈਬ੍ਰੇਰੀ 'ਚ ਸ ਹੈ ਮੈਂ ਬਚਪਨ ਵਿੱਚ ਜੋ ਜਿਵੇਂ ਕਿ ਮੋਟੀਵੇਸ਼ਨਲ ਕਹਾਣੀਆਂ ਨਾਲ ਸੰਬੰਧਿਤ ਮੈਂ ਬਹੁਤ ਸਾਰੀਆਂ ਸਟੋਰੀਆਂ ਪੜ੍ਹੀਆਂ ਜਿਹਨਾਂ ਦੇ ਰਾਹੀਂ ਕਿ ਮੈਨੂੰ ਜੋ ਕਿ ਅੱਜ ਮੇਰੀ ਮਤਲਬ ਮੈਂ ਆਪਣੀ ਰੀਅਲ ਲਾਈਫ ਵਿੱਚੋਂ ਨਾ ਸਾਰੀਆਂ ਚੀਜ਼ਾਂ ਨੂੰ ਰਿਲਾਈਜ ਕਰਦੀ ਹਾਂ ਅਤੇ ਮੈਂ ਮੇਰੇ ਸਕੂਲ ਵਿੱਚ ਇੱਕ ਲਾਈਬ੍ਰੇਰੀ ਸੀ ਜਿੱਥੇ ਜਾ ਕੇ ਫ੍ਰੀ ਪੀਰੀਅਡ ਜਾਂ ਫ੍ਰੀ ਟਾਈਮ ਬੱਚਿਆਂ ਨੂੰ ਕਿਤਾਬਾਂ ਦਿੱਤੀਆਂ ਜਾਂਦੀਆਂ ਸੀ ਅਤੇ ਮੈਨੂੰ ਜੋ ਹੈ ਕਿਤਾਬਾਂ ਕਹਾਣੀਆਂ ਪੜ੍ਹਨਾ ਮੈਨੂੰ ਬਹੁਤ ਪਸੰਦ ਹੈ ਜਿਨ੍ਹਾਂ ਤੋਂ ਕਿ ਇੱਕ ਸਿੱਖਿਆ ਪ੍ਰਾਪਤ ਹੁੰਦੀ ਸੀ ਜੋ ਕਿ ਸਾਡੀ ਆਉਣ ਵਾਲੀ ਜ਼ਿੰਦਗੀ ਵਿੱਚ ਜਾਂ ਸਾਡੇ ਚੱਲ ਰਹੇ ਸਮੇਂ ਵਿੱਚ ਚੱਲ ਰਹੀ ਜੀਵਨ ਵਿੱਚ ਸਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀਆਂ ਹਨ ਇਸ ਕਰਕੇ ਮੈਂ ਬਚਪਨ ਵਿੱਚ ਕਹਾਣੀਆਂ ਮੋਰਲ ਸਟੋਰੀਜ਼ ਪੜ੍ਹਨਾ ਮੈਂ ਬਹੁਤ ਜ਼ਿਆਦਾ ਪਸੰਦ ਕਰਦੀ ਸੀ